ਮੈਂ ਪੇਂਟਿੰਗ ਸਕੂਲ ਵਿੱਚ ਵੀ ਸਿੱਖੀ ਹੈ ਅਤੇ ਬਾਹਰੋਂ ਵੀ ਸਿੱਖੀ ਹੈ ਸਕੂਲ ਵਿੱਚ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਤਾਂ ਸਵੇਰੇ ਜਦੋਂ ਪ੍ਰੇਅਰ ਦਾ ਸਮੇਂ ਹੁੰਦਾ ਸੀ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਸੀ ਉਸ ਵੇਲੇ ਮੇਰੀ ਬੋਰਡ ਉੱਤੇ ਪੇਂਟਿੰਗ ਕਰਨ ਦੀ ਵੀ ਡਿਊਟੀ ਲੱਗਦੀ ਸੀ ਪਰਮਾਤਮਾ ਨੂੰ ਯਾਦ ਕਰਦੇ ਕਰਦੇ ਮੈਂ ਪੇਂਟਿੰਗ ਬਣਾਉਂਦਾ ਸੀ ਅਤੇ ਪੇਂਟਿੰਗ ਬਹੁਤ ਸੋਹਣੀ ਬਣਦੀ ਸੀ ਸਾਰੇ ਸਕੂਲ ਦੇ ਬੱਚੇ ਉਸ ਬੋਰਡ ਨੂੰ ਵੇਖ ਕੇ ਖੁਸ਼ ਹੋ ਜਾਂਦੇ ਸਨ ਕਿ ਕਿੰਨੀ ਸੋਹਣੀ ਪੇਂਟਿੰਗ ਹੈ ਇਹ ਪੇਂਟਿੰਗ ਸਾਡੇ ਅਧਿਆਪਿਕਾ ਨੇ ਡਰਾਇੰਗ ਮਾਸਟਰਾਂ ਨੇ ਵੀ ਸਾਨੂੰ ਸਿਖਾਈ ਅਤੇ ਮੈਂ ਬਾਹਰੋਂ ਵੀ ਸਿੱਖੀ ਹੈ ਬਹੁਤ ਸੋਹਣੀ ਪੇਂਟਿੰਗ ਸਿ ਸਿੱਖੀ ਹੈ ਪਹਿਲਾਂ ਸਾਨੂੰ ਜੇ ਚਿਹਰਾ ਬਣਾਉਣਾ ਸੀ ਤਾਂ ਅੱਖ ਤੋ ਬਣਾਉਣਾ ਸ਼ੁਰੂ ਕਰਦੇ ਸੀ ਅੱਖ ਤੋਂ ਬਣਾਉਣਾ ਨੱਕ ਬਣਾਉਣੇ ਬੁੱਲ੍ਹ ਬਣਾਉਣੇ ਰੰਗ ਭਰਨੇ ਅਲੱਗ ਅਲੱਗ ਤਰ੍ਹਾਂ ਦੇ ਕਿਹੜੇ ਰੰਗ ਨੂੰ ਕਿਹੜੇ ਰੰਗ ਵਿੱਚ ਮਿਲਾਇਆ ਜਾਵੇ ਤਾਂ ਕਿਹੜਾ ਰੰਗ ਬਣਦਾ ਹੈ ਪ੍ਰਾਈਮਰੀ ਰੰਗਾਂ ਨੂੰ ਮਿਲਾ ਕੇ ਸਕੈਂਡਰੀ ਰੰਗ ਬਣਾਉਣੇ ਸਿਖਾਏ ਹਰ ਤਰ੍ਹਾਂ ਦੀ ਪੇਂਟਿੰਗ ਓਇਲ ਪੇਂਟਿੰਗ ਪੇਸਟਲ ਪੇਂਟਿੰਗ ਵਾਟਰ ਪੇਂਟਿੰਗ ਹਰ ਤਰ੍ਹਾਂ ਦੀ ਪੇਂਟਿੰਗ ਹਰ ਸ਼ੀਟ 'ਤੇ ਪੇਂਟਿੰਗ ਕਰਨੀ ਸਿੱਖੀ ਨੋਰਵੇ ਸ਼ੀਟ 'ਤੇ ਪੇਂਟਿੰਗ ਕਰਨੀ ਹੈਂਡਮੇਡ ਸ਼ੀਟ 'ਤੇ ਪੇਂਟਿੰਗ ਕਰਨੀ ਸਿੱਖੀ ਤਰ੍ਹਾਂ ਤਰ੍ਹਾਂ ਦੀ ਪੇਂਟਿੰਗ ਸਿੱਖੀ ਅਤੇ ਮੈਨੂੰ ਪੇਂਟਿੰਗ ਕਰਨ 'ਤੇ ਬਹੁਤ ਹੀ ਆਨੰਦ ਆਉਂਦਾ ਸੀ ਕਿਉਂਕਿ ਇਹ ਮੇਰੀ ਇੱਕ ਸ਼ੌਕ ਸੀ ਜੇ ਆਪਣਾ ਅਸੀਂ ਸ਼ੌਕ ਪੂਰਾ ਕਰਦੇ ਹਾਂ ਜਿਸ ਚੀਜ਼ ਵਿੱਚ ਸ਼ੌਕ ਹੋਵੇ ਉਹ ਸ਼ੌਕ ਨਾਲ ਚੀਜ਼ ਕਰੀਏ ਤਾਂ ਚੀਜ਼ ਕਰਨ 'ਤੇ ਵੀ ਉਹ ਕੰਮ ਕਰਨ 'ਤੇ ਵੀ ਆਨੰਦ ਆਉਂਦਾ ਹੈ ਇਸ ਲਈ ਮੇਰੇ ਅਧਿਆਪਿਕਾ ਨੇ ਮੈਨੂੰ ਸਕੂਲ ਵਿੱਚ ਬਹੁਤ ਹੀ ਸਹੀ ਪਾਸੇ ਲਾ ਕੇ ਮੈਨੂੰ ਮੇਰਾ ਸ਼ੌਕ ਪੂਰਾ ਕਰਾ ਕੇ ਮੈਨੂੰ ਪੇਂਟਿੰਗ ਸਿਖਾਈ ਧੰਨਵਾਦ